ਪਠਾਨਕੋਟ ਜ਼ਿਲ੍ਹੇ ਵਿੱਚ ਹਿੰਦੂ ਸਿੱਖ ਈਸਾਈ ਔਰ ਗੁੱਜਰ ਜੋ ਕਿ ਟਰਾਈਵਲ ਲੋਕ ਹੁੰਦੇ ਹਨ ਇਹ ਆ ਕੇ ਰਹਿੰਦੇ ਹਨ ਔਰ ਇਹਨਾਂ ਵਿੱਚ ਗੱਲਬਾਤ ਵੀ ਆਮ ਹੀ ਲੋਕਾਂ ਵਾਂਗ ਹੁੰਦੀ ਹੈ ਇਹ ਇਹਨਾਂ ਵਿੱਚ ਗੱਲਬਾਤ ਦਾ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਆਮ ਤੌਰ 'ਤੇ ਹੀ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ ਔਰ ਸਾਡੇ ਏ ਸਾਡੇ ਪਠਾਨਕੋਟ ਵਿੱਚ ਗੁੱਜਰ ਹੀ ਹਨ ਜੋ ਕਿ ਦੂਸਰੀ ਜਾਤ ਤੋਂ ਸਬੰਧ ਰੱਖਦੇ ਹਨ ਔਰ ਕ੍ਰਿਸਚਨ ਲੋਕ ਵੀ ਹੁੰਦੇ ਹਨ ਔਰ ਸਾਡੇ ਜ਼ਿਲ੍ਹੇ ਵਿੱਚ ਤੇ ਆਲੇ ਦੁਆਲੇ ਦੇ ਭਾਸ਼ਾ ਵੀ ਬਦਲਦੀ ਹੈ ਸਾਡੇ ਜ਼ਿਲ੍ਹਿਆਂ ਵਿੱਚ ਭਾਸ਼ਾਈ ਅੰਤਰ ਹਨ ਕਿਉਂਕਿ ਸਾਡੇ ਪੰਜਾਬ ਵਿੱਚ ਕਈ ਲੋਕ ਮ ਮਾਝੇ ਇਲਾਕੇ ਵਿੱਚ ਰਹਿੰਦੇ ਹਨ ਕਈ ਮਾਲਵੇ ਇਲਾਕੇ ਵਿੱਚ ਅਤੇ ਕਈ ਦੁਆਬੇ ਇਲਾਕੇ ਵਿੱਚ ਅਤੇ ਇਹਨਾਂ ਤਿੰਨਾਂ ਇਲਾਕਿਆਂ ਦੇ ਲੋਕਾਂ ਦੀ ਬੋਲੀ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹੈ ਇਸ ਕਰਕੇ ਸਾਡੇ ਭਾਸ਼ਾਈ ਬਦਲਾਅ ਜ਼ਿਲ੍ਹਿਆਂ ਦੇ ਤੌਰ 'ਤੇ ਆਉਂਦਾ ਹੀ ਰਹਿੰਦਾ ਹੈ ਧੰਨਵਾਦ